ਚਿੱਤਰਕਾਰੀ ਕਰਦੇ ਹੋਏ ਮੈਂ ਡੋਮੈਸਟਿਕ ਸਪਲਾਈ ਦੀ ਵਰਤੋਂ ਕਰਦਾ ਹਾਂ ਜੋ ਵੀ ਚੀਜ਼ਾਂ ਭਾਰਤ ਦੇ ਵਿੱਚ ਬਣੀਆਂ ਹੁੰਦੀਆਂ ਹਨ ਮੈਂ ਉਹਨਾਂ ਦੀ ਹੀ ਵਰਤੋਂ ਕਰਦਾ ਹਾਂ ਮੇਰੇ ਕੁਛ ਪਸੰਦੀਦਾ ਪੇਂਟਿੰਗ ਦੇ ਬ੍ਰਾਂਡਸ ਹਨ ਫਾਈਨ ਕਰਾਫਟ ਅਤੇ ਇੰਡੋ ਕਰਾਫਟ ਇੱਕ ਫੇਵਰ ਕਾਸਲ ਜੋ ਕਿ ਮੈਨੂੰ ਕਾਫੀ ਪਸੰਦੀਦਾ ਹਨ ਇਹ ਸਮਾਨ ਸਾ ਇਹ ਸਾਰਾ ਸਮਾਨ ਮੈਂ ਔਨਲਾਈਨ ਮੰਗਵਾਉਂਦਾ ਜਿਸ ਨਾਲ ਮੇਰਾ ਫਾਇਦਾ ਵੀ ਹੋ ਜਾਂਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਮਹਿੰਗਾਈ ਚੱਲ ਰਹੀ ਹੈ ਤਾਂ ਪੇਂਟਿੰਗ ਦਾ ਸਮਾਨ ਵੀ ਕਾਫੀ ਜ਼ਿਆਦਾ ਮਹਿੰਗਾ ਹੋ ਹੋ ਗਿਆ ਹੈ ਕਈ ਕਈ ਵਾਰ ਕੁਛ ਪੇਂਟਸ ਇੰਨੇ ਮਹਿੰਗੇ ਹੁੰਦੇ ਹਾਂ ਕਿ ਉਹ ਸਾਡੀ ਰੀਚ ਤੋਂ ਵੀ ਬਾਹਰ ਚਲੇ ਜਾਂਦੇ ਹਨ ਤਾਂ ਕਿ ਸਾਡਾ ਇਸ ਨਾਲ ਕੀ ਹੁੰਦਾ ਹੈ ਕਿ ਸਾਡਾ ਪੇਂਟਿੰਗ ਪੇਂਟਿੰਗ ਬਣਾਉਣ ਦੇ ਵਿੱਚ ਵੀ ਕਾਫੀ ਖਰਚਾ ਆ ਜਾਂਦਾ ਹੈ ਜਿਸ ਨਾਲ ਉਸ ਪੇਂਟਿੰਗ ਦਾ ਦਾਮ ਵੀ ਵੱਧਦਾ ਹਾ ਅਤੇ ਕਸਟਮਰ ਨੂੰ ਵੀ ਫਿਰ ਉਹ ਪੇਂਟਿੰਗ ਅ ਮਹਿੰਗੀ ਲੱਗਦੀ ਆ ਤੋਂ ਇਸ ਕਰਕੇ ਮੈਂ ਸੋਚਦਾ ਹਾਂ ਕਿ ਵੀ ਪੇਂਟਿੰਗ ਦੇ ਸਮਾਨ ਦੇ ਵਿੱਚ ਕਾਫੀ ਮਹਿੰਗਾਈ ਹੋ ਚੁੱਕੀ ਹੈ ਵੀ ਜੋ ਕਿ ਘਟਣੀ ਚਾਹੀਦੀ ਹੈ